ਹੈਲੋ ਹੈਲੋ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਮੈਂ ਤੁਹਾਡੇ ਤੋਂ ਥੋੜ੍ਹੀ ਜੀ ਜਾਣਕਾਰੀ ਲੈਣੀ ਸੀ ਹਾਂਜੀ ਮੈਮ ਉਹ ਮੈਂ ਨਾ ਅਤੇ ਮੇਰਾ ਪਰਿਵਾਰ ਨਾ ਆਪਾਂ ਨਾ ਬਹੁਤ ਸਮਾਂ ਹੋ ਗਿਆ ਆਪਾਂ ਤਾਂ ਕੈਨੇਡਾ ਚਲੇ ਗਏ ਸੀ ਪਹਿਲਾਂ ਪੰਜਾਬ 'ਚ ਰਹਿੰਦੇ ਹੁੰਦੇ ਸੀ ਹਾਂਜੀ ਉਦੋਂ ਤਾਂ ਇੱਥੇ ਜ਼ਿਆਦਾ ਘੁੰਮਣ ਫਿਰਨ ਲਈ ਸਾਧਨ ਨਹੀਂ ਹੁੰਦੇ ਤੇ ਹੁਣ ਅਸੀਂ ਨਾ ਪੰਜਾਬ 'ਚ ਘੁੰਮਣ ਆਏ ਹਾਂ ਅਤੇ ਸਾਨੂੰ ਨਾ ਥੋੜ੍ਹੀਆਂ ਅਲੱਗ ਅਲੱਗ ਜਗ੍ਹਾ ਦੱਸ ਦਿਓ ਕਿ ਘੁੰਮਣ ਫਿਰਨ ਲਈ ਅਤੇ ਉਨ੍ਹਾਂ 'ਤੇ ਜਾਣ ਲਈ ਵਧੀਆ ਸਾਧਨ ਦੱਸ ਦਿਓ ਕੋਈ ਕਿਵੇਂ ਜਾ ਸਕਦੇ ਹਾਂ ਆਪਾਂ ਹਾਂਜੀ ਹਾਂਜੀ ਜੀ ਜੀ

ਠੀਕ ਜੇ ਮੈਡਮ ਅਤੇ ਮੈਮ ਇਹ ਟ੍ਰੇਨ 'ਤੇ ਜਾਣਾ ਸਹੀ ਰਹੇਗਾ ਵੈਸੇ ਜੇ ਅੰਮ੍ਰਿਤਸਰ ਜਾਣਾ ਹੋਵੇ ਤਾਂ ਠੀਕ ਠੀਕ ਅਤੇ ਟਿਕਟ ਟਿਕਟ ਔਨਲਾਈਨ ਬੁੱਕ ਕਰਨੀ ਪਊਗੀ ਸਾਨੂੰ ਕਿ ਉੱਥੋਂ ਸਟੇਸ਼ਨ 'ਤੇ ਹੋਜੂਗੀ ਠੀਕ ਹੈ ਮੈਮ ਹਾਂਜੀ ਧੰਨਵਾਦ